ਨਵਾਂਸ਼ਹਿਰ ਵਿੱਚ ਭਗਤ ਸਿੰਘ ਸਿੰਘ ਦੀ ਬਹੁਤ ਹੀ ਚਰਚਾ ਕੀਤੀ ਜਾਂਦੀ ਹੈ ਸਾਡੇ ਸਕੂਲ ਵੱਲੋਂ ਸਾ ਸਾਡੇ ਸਕੂਲ ਵੱਲੋਂ ਸਾਨੂੰ ਸਾਇੰਸ ਸਿਟੀ ਲਿਜਾਇਆ ਗਿਆ ਸੀ ਉੱਥੇ ਜਾ ਕੇ ਸਾਨੂੰ ਬਹੁਤ ਹੀ ਕੁਝ ਸਿੱਖਣ ਅਤੇ ਦੇਖਣ ਨੂੰ ਮਿਲਿਆ ਸਾਡੇ ਪਿੰਡ ਵਿ ਸਾਡੇ ਵਿੱਚ ਸਾਡੇ ਪਿੰਡ ਵਿੱਚ ਨਾਲ਼ ਹੀ ਨਾਲ਼ ਹੀ ਪਿੰਡ ਨਾਲ਼ ਅਤੇ ਟਿੱਬੀ ਸਾਹਿਬ ਲੱਗਦਾ ਹੈ ਉੱਥੇ ਹੀ ਲੋਕ ਬਹੁਤ ਸਾਰੇ ਸ ਸਸ ਤਿਉਹਾਰ ਨੂੰ ਅਤੇ ਮੱਥਾ ਟੇਕਣ ਜਾਂਦੇ ਹਨ ਉੱਥੇ ਬਹੁਤ ਹੀ ਰਸ਼ ਹੁੰਦਾ ਹੈ ਅਤੇ ਨਾਲ਼ ਹੀ ਟਿੱਬੀ ਸਾਹਿਬ ਦੇ ਨਾਲ਼ ਹੀ ਸਤਲੁਜ ਦਰਿਆ ਵੱਗਦਾ ਹੈ ਅਤੇ ਉੱਥੇ ਬਹੁਤ ਹੀ ਲੋਕ ਮੱਥਾ ਟੇਕਣ ਜਾਂਦੇ ਹਨ ਜਿਵੇਂ ਮੱਥਾ ਟੇਕਣ ਜਾਂਦੇ ਹਨ ਬਹੁਤ ਸਾਰੇ ਲੋਕ ਜਾਂਦੇ ਹਨ ਤਾਂ